ਸਾਡੇ ਇਲਾਕੇ ਦੇ ਪ੍ਰਸਿੱਧ ਸਕੂਲ ਹਨ ਜਿਵੇਂ ਕਿ ਬਾਬਾ ਬੁੱਢਾ ਜੀ ਪਬਲਿਕ ਸਕੂਲ ਦਸ਼ਮੇਸ਼ ਪਰਿਵਾਰ ਸਕੂਲ ਹਾਵਡ ਲੇਨ ਸਕੂਲ ਗੁਰੂ ਹਰਕ੍ਰਿਸ਼ਨ ਸਕੂਲ ਸੈਂਟ ਫਰਾਂਸਿਸ ਸਕੂਲ ਆਦਿ ਪ੍ਰਸਿੱਧ ਸਕੂਲ ਹਨ ਅਤੇ ਸਰਕਾਰੀ ਸਕੂਲ ਵੀ ਹਨ ਅਸੀਂ ਇਹਨਾਂ ਸਕੂਲਾਂ ਦੀ ਪੜ੍ਹਾਈ ਤੋਂ ਸੰਤੁਸ਼ਟ ਹਾਂ ਇੱਥੇ ਬਹੁਤ ਹੀ ਵਧੀਆ ਅਧਿਆਪਕ ਹਨ ਜੋ ਬੱਚਿਆਂ ਨੂੰ ਬਹੁਤ ਮਿਹਨਤ ਅਤੇ ਪਿਆਰ ਨਾਲ ਪੜ੍ਹਾਉਂਦੇ ਹਨ ਅਤੇ ਸਕੂਲ ਵਿੱਚ ਕੰਪਿਊਟਰ ਲੈਬ ਅਤੇ ਖੇਡਣ ਵਾਸਤੇ ਖੁੱਲ੍ਹੇ ਮੈਦਾਨ ਵੀ ਹਨ ਅਤੇ ਇੱਥੇ ਸਾਰੇ ਵਿਸ਼ੇ ਹੀ ਅੰਗਰੇਜ਼ੀ ਵਿੱਚ ਪੜ੍ਹਾਏ ਜਾਂਦੇ ਹਨ ਅਸੀਂ ਵੱਡੇ ਸ਼ਹਿਰ ਦੇ ਸਕੂਲਾਂ ਨੂੰ ਤਰਜੀਹ ਨਹੀਂ ਦਿੰਦੇ ਕਿਉਂਕਿ ਉੱਥੇ ਫੀਸ ਬਹੁਤ ਜ਼ਿਆਦਾ ਹੈ ਅਤੇ ਪਿੰਡ ਤੋਂ ਬਹੁਤ ਦੂਰ ਹਨ